ਮੈਂ ਪਹਿਲਾਂ ਤੋਂ ਹੀ ਵਿਗਿਆਨ ਅਤੇ ਗਣਿਤ ਸ਼ਾਸਤਰ ਵਿੱਚ ਰੁਚੀ ਰੱਖਦਾ ਰਿਹਾ ਹਾਂ ਜਿਸ ਵਿੱਚ ਮੈਂ ਵੱਖ ਵੱਖ ਵਿਗਿਆਨਿਕਾਂ ਗਣਿਤ ਸ਼ਾਸਤਰੀਆਂ ਬਾਰੇ ਪੜ੍ਹਦਾ ਰਿਹਾ ਅਤੇ ਉਹਨਾਂ ਬਾਰੇ ਸੁਣਦਾ ਰਿਹਾ ਹਾਂ ਇਹਨਾਂ ਵਿਗਿਆਨਿਕਾਂ ਵਿੱਚੋਂ ਮੈਨੂੰ ਸਭ ਤੋਂ ਵੱਧ ਪ੍ਰਭਾਵਿਤ ਕਰਨ ਵਾਲੇ ਵਿਗਿਆਨਿਕ ਗਣਿਤ ਸ਼ਾਸਤਰੀ ਭਾਰਤ ਦੇ ਆਰਿਆ ਭੱਟ ਹਨ ਆਰਿਆ ਭੱਟ ਜੀਰੋ ਦੀ ਖੋਜ ਕਰਕੇ ਮੈਨੂੰ ਸਭ ਤੋਂ ਚੰਗੇ ਲੱਗਦੇ ਹਨ ਕਿਉਂਕਿ ਜੀਰੋ ਦੀ ਖੋਜ ਕਰਨ ਉਪਰੰਤ ਉਹਨਾਂ ਨੇ ਸੰਸਾਰ ਵਿੱਚ ਇੱਕ ਵੱਖਰੀ ਪਛਾਣ ਬਣਾਈ ਜੀਰੋ ਦੇ ਆਧਾਰ 'ਤੇ ਹੀ ਸੰਸਾਰ ਦੀ ਗਿਣਤੀ ਟਿਕੀ ਹੈ ਅਤੇ ਕੰਪਿਊਟਰ ਸਾਇੰਸ ਟੈਕਨੋਲੋਜੀ ਦੀ ਸਾਰੀ ਪ੍ਰੋਗਰਾਮਿੰਗ ਜੀਰੋ ਅਤੇ ਇੱਕ ਨੂੰ ਹੀ ਸਮਝਦੀ ਹੈ ਆਰਿਆ ਭੱਟ ਦਾ ਜਨਮ ਵੱਖ ਵੱਖ ਵਿਦਵਾਨਾਂ ਵੱਲੋਂ ਵੱਖ ਵੱਖ ਮੱਤਭੇਦ ਅਤੇ ਵਿਚਾਰ ਰੱਖੇ ਹਨ ਜਿਹਨਾਂ ਵਿੱਚ ਨਰਮਦਾ ਅਤੇ ਗੋਦਾਵਰੀ ਨਦੀ ਦੇ ਵਿਚਕਾਰ ਦੇ ਖੇਤਰ ਵਿੱਚ ਉਹਨਾਂ ਦਾ ਜਨਮ ਮੰਨਿਆ ਜਾਂਦਾ ਹੈ ਆਰਿਆ ਭੱਟ ਸਭ ਤੋਂ ਪਹਿਲਾਂ ਜੀਰੋ ਦੀ ਖੋਜ ਕਰਨ ਦੇ ਨਾਲ ਉਹ ਇੱਕ ਤਾਰਾ ਸ਼ਾਸਤਰ ਯਾਨੀ ਕਿ ਤਾਰਾ ਵਿਗਿਆਨਿਕ ਹਨ ਜਿਹਨਾਂ ਨੇ ਬ੍ਰਹਿਮੰਡ ਵਿੱਚ ਤਾਰਿਆਂ ਦੀ ਗਿਣਤੀ ਦੂਰੀ ਆਦਿ ਦੀ ਵੀ ਖੋਜ ਕਰੀ ਜਿਸ ਕਰਕੇ ਉਹਨਾਂ ਨੇ ਆਪਣੇ ਆਪਣਾ ਨਾਮ ਤਾਰਾ ਵਿਗਿਆਨਿਕਾਂ ਦੀ ਗਿਣਤੀ ਵਿੱਚ ਵੀ ਸ਼ਾਮਿਲ ਕਰ ਲਿਆ